ਹੈਲੋ ਫਰੈਸ਼ ਵੈਜੀਟੇਬਲ ਸਟੋਰ ਬਰਨਾਲਾ ਤੋਂ ਬੋਲਦੇ ਹੋ ਜੀ ਜੀ ਸਾਨੂੰ ਜੀ ਸਬਜ਼ੀਆਂ ਚਾਹੀਦੀਆਂ ਸੀ ਜੀ ਫਰੈਸ਼ ਸਾਡੇ ਜੀ ਦੋ ਤਿੰਨ ਦਿਨ ਜੀ ਫੰਕਸ਼ਨ ਆ ਜੀ ਘਰ ਜੀ ਮੈਰਿਜ ਵੀ ਹੈ ਜੀ ਮੰਗਣਾ ਵੀ ਹੈ ਜੀ ਹਾਂਜੀ ਸਬਜ਼ੀ ਫਰੈਸ਼ ਚਾਹੀਦੀ ਹਾਂਜੀ ਠੀਕ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਰਨਾਲਾ ਹਾਂਜੀ ਹਾਂਜੀ ਅੱਛਾ ਜੀ ਲੋਕੇਸ਼ਨ ਕੀ ਵਜਦੀ ਜੀ ਆਪਣੀ ਜੀ ਹਾਂਜੀ ਅੱਛਾ ਜੀ ਠੀਕ ਹਰ ਇੱਕ ਵੈਜੀਟੇਬਲ ਮਿਲ ਜੂਗੀ ਜੀ ਅੱਛਾ ਜੀ ਸਾਨੂੰ ਹੰਡਾਇਆ ਸ਼ਹਿ ਹੰਡਾਇਆ ਜੀ ਪਿੰਡ ਵਿੱਚ ਚਾਹੀਦੀ ਸੀ ਆਈ ਸਟਾਫ ਦੇ ਬੈਕ ਸਾਈਡ

ਹਾਂਜੀ ਅੱਛਾ ਜੀ ਓਰਡਰ ਜੀ ਓਰਡਰ ਤੁਸੀਂ ਘਰ ਭੁਗਤਾਨ ਕਰ ਦੋਗੇ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਓਕੇ ਜੀ